ਹੈਲੋ ਸਰ ਸਵਿਗੀ ਤੋਂ ਬੋਲ ਰਹੇ ਹੋ ਮੈਂ ਤੁਹਾਨੂੰ ਔਡਰ ਕੀਤਾ ਸੀਗਾ ਪੀਜ਼ਾ ਪਨੀਰ ਬਰਗਰ ਅਤੇ ਡੋਸਾ ਅਤੇ ਇਹ ਔਡਰ ਮੈਂ ਤੁਹਾਨੂੰ ਕੀਤਾ ਸੀ ਅਤੇ ਹੁਣ ਮੈਂ ਇਹ ਕੈਂਸਲ ਕਰਵਾਉਣਾ ਹੈ ਕਿਉਂਕਿ ਅਚਾਨਕ ਹੀ ਸਾਨੂੰ ਕਿਤੇ ਜਾਣਾ ਪੈ ਗਿਆ ਹੈ ਅਤੇ ਮੈਂ ਇਸ ਔਡਰ ਦੀ ਪੇਮੈਂਟ ਪਹਿਲਾਂ ਹੀ ਕਰ ਚੁੱਕੀ ਹਾਂ ਅਤੇ ਹੁਣ ਤੁਸੀਂ ਮੈਨੂੰ ਜਿਹੜੀ ਮੈਂ ਪੇਮੈਂਟ ਕਰ ਚੁੱਕੀ ਹਾਂ ਇਹ ਤੁਸੀਂ ਮੈਨੂੰ ਮਤਲਬ ਮੇਰਾ ਬੈਲੇਂਸ ਜਿਹੜਾ ਮੈਨੂੰ ਵਾਪਸ ਕਰ ਦਿਓ ਅਤੇ ਮੇਰੇ ਜਿਹੜੇ ਹੈਗੀ ਆ ਮੇਰੇ ਔਡਰ ਦਾ ਨੰਬਰ ਹੈਗਾ ਵਾ ਵੀਹ ਸਤਾਈ ਅਤੇ ਅਤੇ ਜਿਹੜਾ ਮੇਰਾ ਭੁਗਤਾਨ ਰਹਿ ਚੁੱਕਿਆ ਵਾ ਅਤੇ ਉਹ ਤੁਸੀਂ ਜਾਂ ਮੈਨੂੰ ਔਨਲਾਈਨ ਹੀ ਕਰ ਦਿਓ ਜਾਂ ਫਿਰ ਤੁਸੀਂ ਮੈਨੂੰ ਕੈਸ਼ ਦੇ ਦਿਓ ਅਤੇ ਤੁਹਾਡੇ ਤੇ ਸਰ ਇੱਕ ਰੇਕੁਐਸਟ ਹੈ ਕਿ ਇਹ ਜਿਹੜਾ ਮੇਰਾ ਆਰਡਰ ਹੈ ਇਹ ਕੈਂਸਲ ਕਰ ਦਿੱਤਾ ਜਾਵੇ